ਜਿਹੜੇ ਦਿਹਾਤੀ ਖੇਤਰ ਹੁੰਦੇ ਆ ਇਹਨਾਂ ਜਗ੍ਹਾਵਾਂ ਦੇ ਉੱਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਇਹ ਜਿਹੇ ਲੋਕ ਹੈਗੇ ਆ ਇਨ ਟੈਕਨੋਲਜੀ ਤੋਂ ਬਹੁਤ ਪਿੱਛੇ ਹੁੰਦੇ ਆ ਮਤਲਬ ਇਹਨਾਂ ਜਗ੍ਹਾਵਾਂ 'ਤੇ ਟੈਕਨੋਲਜੀ ਬਹੁਤ ਘੱਟ ਹੁੰਦੀ ਹਾ ਅਤੇ ਇੱਥੇ ਜੇ ਕਿਸੇ ਨੇ ਫੋਨ ਵੀ ਕਰਨਾ ਹੋਵੇ ਲੋਕਾਂ ਨੇ ਆਪਣਾ ਸੰਪਰਕ ਕਰਨਾ ਹੋਵੇ ਉਹ ਬਹੁਤ ਮੁਸ਼ਕਿਲ ਨਾਲ ਹੁੰਦਾ ਵਾ ਸਗੋਂ ਲੋਕਾਂ ਨੂੰ ਜੇ ਆਪਦੇ ਕੰਮ ਹੁੰਦੇ ਨਿੱਕੇ ਮੋਟੇ ਉਹ ਦੂਜੇ ਸ਼ਹਿਰਾਂ ਵੱਲ ਜਾ ਕੇ ਕਰਵਾਉਣੇ ਪੈਂਦੇ ਆ ਅਤੇ ਉਹ ਸ਼ਹਿਰ ਵੀ ਬਹੁਤ ਦੂਰ ਹੁੰਦੇ ਇਹਨਾਂ ਦੀ ਜਗ੍ਹਾਵਾਂ ਤੋਂ ਅਤੇ ਇਹ ਜਿਹੜੇ ਖੇਤਰ ਹੁੰਦੇ ਆ ਇਹਨਾਂ ਦੇ ਵਿੱਚ ਸਰਵਰ ਨਹੀਂ ਹੁੰਦਾ ਹੈਗਾ ਕਿਸੇ ਤਰ੍ਹਾਂ ਟੈਕਨੋਲਜੀ ਨਹੀਂ ਹੁੰਦੀ ਹੈਗੀ ਬਿਜਲੀ ਦੀ ਵੀ ਬਹੁਤ ਜ਼ਿਆਦਾ ਸਮੱਸਿਆਵਾਂ ਹੁੰਦੀਆਂ ਇਹਨਾਂ ਖੇਤਰਾਂ ਦੇ ਵਿੱਚ ਬਿਜਲੀ ਵੀ ਬਹੁਤ ਘੱਟ ਆਉਂਦੀ ਆ ਲੋਕ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਆ